ਡਰਾਇੰਗ ਕਰਨਾ ਮੇਰੀ ਇੱਕ ਹੋਬੀ ਹੈ ਮੈਂ ਆਪਣਾ ਵਿਹਲਾ ਟੰਮ ਟਾਈਮ ਡਰਾਇੰਗ ਕਰਕੇ ਬਤੀਤ ਕਰਦੀ ਹਾਂ ਅਤੇ ਮੈਂ ਇਹ ਕੋਈ ਫੈਸਲਾ ਨਹੀਂ ਲੈਂਦੀ ਕਿ ਮੈਂ ਕੀ ਬਣਾਉਣਾ ਹੈ ਮੇਰੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਦੇਖ ਕੇ ਵਿਚਾਰ ਆ ਜਾਂਦਾ ਹੈ ਜਾਂ ਮੇਰਾ ਮਨ ਕਰਦਾ ਹੈ ਕਿ ਮੈਂ ਕੁਦਰਤ ਦੇ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਨੂੰ ਬਣਾਵਾਂ ਕਿਉਂਕਿ ਮੈਨੂੰ ਕੁਦਰਤ ਨੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਮੇਰੇ ਕੋਲ ਕੋਈ ਖਾਸ ਵਿਸ਼ਾ ਜਾਂ ਥੀਮ ਨਹੀਂ ਹੈ ਪਰ ਮੈਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਬਣਾਉਣ ਵਿੱਚ ਦਿਲਚਸਪੀ ਰੱਖਦੀ ਹੈ ਡਰਾਇੰਗ ਕਰਨਾ ਮੇਰਾ ਵਿਹਲਾ ਟਾਈਮਪਾਸ ਕਰਨ ਦਾ ਇੱਕ ਸਭ ਤੋਂ ਵਧੀਆ ਤਰੀਕਾ ਹੈ ਜਿਸਦੇ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਮੇਰਾ ਦਿਮਾਗ ਤਰੋ ਤਾਜ਼ਾ ਹੋ ਜਾਂਦਾ ਹੈ ਡਰਾਇੰਗ ਕਰਨਾ ਮੇਰਾ ਇੱਕ ਸ਼ੌਂਕ ਹੈ ਜੋ ਕਿ ਮੈਂ ਬਚਪਨ ਤੋਂ ਹੀ ਕਰ ਰਹੀ ਹਾਂ ਡਰਾਇੰਗ ਕਰਨਾ ਮੇਰਾ ਸਭ ਤੋਂ ਵਧੀਆ ਕੰਮ ਮੰਨਦੀ ਹਾਂ ਮੈਂ ਅਤੇ ਮੇਰੀ ਡਰਾਇੰਗ ਇੰਨੀ ਜ਼ਿਆਦਾ ਵਧੀਆ ਹੈ ਕਿ ਮੇਰੀ ਡਰਾਇੰਗ ਐਗਜੀਬਿਸ਼ਨ ਜਾਂ ਕਿਸੇ ਵੀ ਪ੍ਰੈਜੈਂਟੇਸ਼ਨ ਦੇ ਰੂਪ ਦੇ ਵਿੱਚ ਵੀ ਅਲੱਗ ਅਲੱਗ ਸੰਸਥਾਵਾਂ ਵਿੱਚ ਦੇਖੀ ਜਾ ਸਕਦੀ ਹੈ ਮੈਂ ਆਪਣੇ ਆਪ ਨੂੰ ਕੋਈ ਬਹੁਤ ਜ਼ਿਆਦਾ ਬੜੀ ਚਿੱਤਰਕਾਰ ਜਾਂ ਆਰਟਿਸਟ ਨਹੀਂ ਮੰਨਦੀ ਪਰ ਡਰਾਇੰਗ ਕਰਨਾ ਮੇਰਾ ਸ਼ੌਂਕ ਹੈ ਅਤੇ ਆਪਣਾ ਮੈਂ ਫਰੀ ਟਾਈਮ ਡਰਾਇੰਗ ਕਰਕੇ ਬਤੀਤ ਕਰਦੀ ਹਾਂ ਡਰਾਇੰਗ ਕਰਨ ਨਾਲ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਹੁੰਦੀ ਹੈ ਜੋ ਲੋਕ ਮਾਨਸਿਕ ਤੌਰ 'ਤੇ ਪਰੇਸ਼ਾਨ ਹਨ ਉਹਨਾਂ ਨੂੰ ਡਰਾਇੰਗ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਆਪਣਾ ਹਾਵ ਭਾਵ ਡਰਾਇੰਗ ਕਰਕੇ ਦਿਖਾ ਸਕਦੇ ਹਾਂ ਡਰਾਇੰਗ ਇੱਕ ਇਹੇ ਜੀ ਪੇਸ਼ਕਾਰੀ ਹੈ ਜਿਸ ਨਾਲ ਤੁਸੀਂ ਬਿਨਾਂ ਬੋਲੇ ਕਿਸੇ ਨੂੰ ਹਿਲਾ ਸਕਦੇ ਹੋ ਉਹ ਬਹੁਤ ਹੀ ਜ਼ਿਆਦਾ ਕਿਸੇ ਦੇ ਮਨ 'ਤੇ ਪ੍ਰਭਾਵ ਪਾ ਸਕਦੀ ਹੈ ਡਰਾਇੰਗ ਹਰ ਇੱਕ ਨੂੰ ਨਹੀਂ ਵਧੀਆ ਲੱਗਦੀ ਪਰ ਜਿਸ ਇਨਸਾਨ ਨੂੰ ਡਰਾਇੰਗ ਦੇ ਨਾਲ ਪਿਆਰ ਹੈ ਉਹ ਉਸਨੂੰ ਕਦੇ ਵੀ ਨਹੀਂ ਛੱਡ ਸਕਦਾ